ਬਰਨਾਲਾ ਉੱਨੀ ਤਰੀਕ ਗਿਆਰਵਾਂ ਮਹੀਨਾ ਦੋ ਹਜ਼ਾਰ ਛੇ ਨੂੰ ਜ਼ਿਲ੍ਹਾ ਬਣਿਆ ਅਤੇ ਸੁਰਜੀਤ ਸਿੰਘ ਢਿੱਲੋਂ ਬਰਨਾਲਾ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤੇ ਜਾਣ ਵਾਲੇ ਪਹਿਲੇ ਵਿਅਕਤੀ ਸਨ ਜ਼ਿਲ੍ਹਾ ਬਰਨਾਲਾ ਦੀਆਂ ਦੋ ਸਬ ਡਵਿਜ਼ਨਾਂ ਬਰਨਾਲਾ ਅਤੇ ਤਪਾ ਤਿੰਨ ਸਬ ਤਹਿਸੀਲਾਂ ਤਪਾ ਭਦੌੜ ਧਨੌਲਾ ਅਤੇ ਤਿੰਨ ਬਲਾਕ ਬਰਨਾਲਾ ਸੈਣਾ ਅਤੇ ਮਹਿਲਕਲਾਂ ਹਨ ਰਾਮ ਸਰੂਪ ਅਣਖੀ ਪੰਜਾਬੀ ਲੇਖਕ ਨਾਵਲਕਾਰ ਅਤੇ ਕਵੀ ਹਨ ਉਸ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਬਾਬਾ ਲੰਮਰ ਸਿੰਘ ਨੇ ਆਪਣੇ ਇੱਕ ਸ਼ਾਗਿਰਦ ਪੰਡਿਤ ਨਿੱਕਾ ਸਿੰਘ ਨੂੰ ਇਹ ਕਾਰਜ ਕਰਨ ਲਈ ਨਿਯੁਕਤ ਕੀਤਾ ਮਹਾਰਾਜਾ ਆਲਾ ਸਿੰਘ ਨੇ ਬਾਬਾ ਲੰਮਰ ਸਿੰਘ ਅਤੇ ਪੰਡਿਤ ਨਿੱਕਾ ਸਿੰਘ ਬਾਰੇ ਵੀ ਬਹੁਤ ਕੁਝ ਸੁਣਿਆ ਸੀ ਅਤੇ ਇਹ ਵੀ ਕਿ ਜਦੋਂ ਮਹਾਰਾਜਾ ਨੇ ਆਪਣੀ ਧੀ ਲਈ ਅਧਿਆਪਕ ਬਾਰੇ ਪੁੱਛਿਆ ਤਾਂ ਉਸਦਾ ਨਾਮ ਪੰਡਿਤ ਨਿੱਕਾ ਸਿੰਘ ਸੀ ਬਾਬਾ ਲੰਮਰ ਸਿੰਘ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਪੰਡਿਤ ਨਿੱਕਾ ਸਿੰਘ ਬਰਨਾਲਾ ਪਹੁੰਚੇ ਅਤੇ ਇੱਥੇ ਮਹਾਰਾਜਾ ਆਲਾ ਸਿੰਘ ਨੇ ਪੰਡਿਤ ਨਿੱਕਾ ਸਿੰਘ ਨੂੰ ਇੱਕ ਬਹੁਤ ਹੀ ਸੁੰਦਰ ਘਰ ਤੋਹਫੇ ਵਜੋਂ ਦਿੱਤਾ ਅਤੇ ਉਹਨਾਂ ਨੇ ਇਸ ਅਸਥਾਨ 'ਤੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਤਰ੍ਹਾਂ ਡੇਰਾ ਬਾਬਾ ਗਾਂਧਾ ਸਿੰਘ ਜੀ ਹੋਂਦ ਵਿੱਚ ਆਇਆ ਅਤੇ ਲੰਗਰ ਨਿਯਮਤ ਤੌਰ 'ਤੇ ਚਾਲੂ ਕੀਤਾ ਗਿਆ ਕਿਲ੍ਹੇ ਵਿੱਚ ਆਧਾਰ ਅੱਜ ਕੱਲ੍ਹ ਵੀ ਕਿਲ੍ਹੇ ਵਿੱਚ ਬਾਬਾ ਆਲਾ ਸਿੰਘ ਦਾ ਤੰਦੂਰ ਦੇਖਣ ਨੂੰ ਮਿਲਦਾ ਹੈ ਇਹ ਗੁਰਦੁਆਰਾ ਬਾਬਾ ਚੂਲਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ ਕਿਹਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਬਰਨਾਲੇ ਨੂੰ ਪਹਿਲਾਂ ਅਨਾਹਤਗੜ੍ਹ ਕਿਹਾ ਜਾਂਦਾ ਸੀ ਹੋ ਸਕਦਾ ਹੈ ਕਿ ਬਾਬਾ ਆਲਾ ਸਿੰਘ ਦੇ ਇਸ ਇਲਾਕੇ ਨੂੰ ਆਪਣਾ ਹੋਣ ਦਾ ਦਾਅਵਾ ਕਰਨ ਤੋਂ ਬਹੁਤ ਪਹਿਲਾਂ ਇਸ ਥਾਂ 'ਤੇ ਕੋਈ ਗੜ੍ਹ ਜਾਂ ਕਿਲ੍ਹਾ ਸੀ ਹਾਲਾਂਕਿ ਅਤੀਤ ਦੇ ਅਜਿਹੇ ਅਵਸ਼ੇਸ਼ ਹੁਣ ਨਹੀਂ ਹਨ ਬਰਨਾਲਾ ਦਾ ਇਤਿਹਾਸ ਅਮਲੀ ਤੌਰ 'ਤੇ ਆਲਾ ਸਿੰਘ ਜੀ ਦੇ ਇਤਿਹਾਸ ਨਾਲ ਸ਼ੁਰੂ ਹੁੰਦਾ ਹੈ